ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਘਰ ਪਰਿਵਾਰ ਠੀਕ ਠਾਕ ਹਾਂਜੀ ਠੀਕ ਅੱਛਾ ਜੀ ਤੁਸੀਂ ਜਾਣਾ ਕਿੱਥੇ ਕਿੱਥੇ ਭਾਅ ਜੀ ਅੱਛਾ ਠੀਕ ਹੈ ਇੱਦਾਂ ਭਾਅ ਜੀ ਇੱਥੇ ਨਾ ਰਸ਼ ਬਹੁਤ ਆ ਅਤੇ ਤੁਸੀਂ ਨਵੇਂ ਆਏ ਜੋ ਅਤੇ ਠੀਕ ਹੈ ਤਾਂ ਤੁਹਾਨੂੰ ਇੱਥੋਂ ਦਾ ਬਹੁਤਾ ਪਤਾ ਨਹੀਂ ਲੱਗਣਾ ਠੀਕ ਹੈ ਹਾਂ ਇੱਕ ਆਟੋ ਵਗੈਰਾ ਵਾਲੇ ਖ਼ਰਾਬ ਕਰਦੇ ਨੇ ਤੁਸੀਂ ਇੱਦਾਂ ਕਰੋ ਆਪਣੀ ਗੱਡੀ ਕਰ ਲਉ ਰੈਂਟ 'ਤੇ ਹਾਂ ਹਾਂਜੀ ਅਤੇ ਉਹ ਤੁਸੀਂ ਜਿੱਥੇ ਮਰਜ਼ੀ ਉਹਦੇ 'ਤੇ ਜਾਓ ਬੜਾ ਵਧੀਆ ਰਹੂਗਾ ਤੁਹਾਡੇ ਲਈ ਉੱਦਾਂ ਤਾਂ ਇੱਥੇ ਬਹੁਤ ਔਫਿਸ ਹੈਗੇ ਆ ਤੁਸੀਂ ਅੰਮ੍ਰਿਤਸਰ ਆਓਗੇ ਜਦੋਂ ਤਾਂ ਇੱਥੇ ਤੁਹਾਨੂੰ ਰੇਲਵੇ ਸਟੇਸ਼ਨ ਦੇ ਬਾਹਰ ਹੀ ਮਿਲ ਜਾਣੇ ਗੱਡੀਆਂ ਵਾਲੇ ਹਾਂ ਉੱਥੋਂ ਵੀ ਕਰ ਸਕਦੇ ਜੇ ਔਨਲਾਈਨ ਕਰਨਾ ਚਾਹੋ ਤਾਂ ਔਨਲਾਈਨ ਵੀ ਕਰ ਸਕਦੇ ਜੇ ਤੁਸੀਂ ਇੱਕ ਤਾਂ ਓਲਾ ਵਗੈਰਾ ਦੂਸਰੀਆਂ ਚੱਲਦੀਆਂ ਨੇ ਤੇ ਪਰ ਬਣੂਗੀ ਇੱਥੇ ਤੁਸੀਂ ਕਰਾ ਸਕਦੇ ਜੇ ਬੁਕਿੰਗ ਹਾਂਜੀ ਓਕੇ ਜੀ ਓਕੇ ਓਕੇ